ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਡਮ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਸਿਖਿਆ ਦਾਂਗੇ ਉਵੇਂ ਬੱਚੇ ਨੂੰ ਤੁਸੀਂ ਪੁੱਛ ਸਕਦੇ ਹੋ ਬੱਚੇ ਹਾਂਜੀ ਹਾਂਜੀ ਹਾਂਜੀ ਬੱਚਿਆਂ ਨੂੰ ਪੁੱਛ ਸਕਦੇ ਹੋ ਵੀ ਤੁਹਾਨੂੰ ਖੇਡ ਕਿਹੜੀ ਪਸੰਦ ਆ ਜੀ ਓਕੇ ਜੀ ਹਾਂਜੀ ਕੁਸ਼ਤੀ ਦੇ ਵੀ ਬਹੁਤ ਵਧੀਆ ਕੋਚ ਜੀ ਰੱਖੇ ਹੋਏ ਆ ਆਪਣੇ ਕੋਲ ਹਾਂਜੀ ਆਪਣੇ ਕੋਲ ਬ ਬਹੁਤ ਵਧੀਆ ਕੋਚ ਰੱਖੇ ਹੋਏ ਨੇ ਅਤੇ ਹਾਂਜੀ ਵਧੀਆ ਬੱਚੇ ਆਪਣੇ ਕੋਲ ਆਉਂਦੇ ਨੇਗੇ ਬਰਨਾਲੇ ਤੋਂ ਵੀ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਹਾਂਜੀ ਇਹਨਾਂ ਦੀ ਕਲਾਸਾਂ ਲੱਗਦੀਆਂ ਨੇ ਜੀ ਹਾਂਜੀ ਤੁਸੀਂ ਭੇਜ ਸਕਦੇ ਹੋ ਜਦੋਂ ਮਰਜ਼ੀ ਬਹੁਤ ਵਧੀਆ ਕੋਚ ਰੱਖੇ ਹੋਏ ਨੇ ਆਪਣੇ ਕੋਲ ਹਾਂਜੀ ਹਾਂਜੀ ਜੀ ਖੇਡ ਆਪਣੇ ਕੋਲ ਹੋਕੀ ਹੋ ਗਈ ਜਿਵੇਂ ਕਿ ਕਰਾਟੇ ਅਤੇ ਬਾਸਟਿੰਗਬਾਲ ਬਾਲ ਠੀਕ ਹੈ ਜੀ ਅਤੇ ਆਪਣੇ ਹੋਕੀ ਦੀ ਖੇਡਾਂ ਹੋ ਗਈਆਂ ਹੋਰ ਬ ਕਾਫ਼ੀ ਖੇਡਾਂ ਨੇ ਜੀ ਆਪਣੇ ਕੋਲ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੀਆਂ ਹਾਂਜੀ ਹਾਂਜੀ ਬਰਨਾਲੇ ਆ ਜਾਇਓ ਤੁਸੀਂ ਕਲੱਬ ਹਾਲ ਦੇ ਵਿੱਚ ਹਾਂਜੀ ਹਾਂਜੀ ਜਦੋਂ ਮਰਜ਼ੀ ਆ ਜਾਇਓ ਨੌ ਵਜੇ ਆਪਣਾ ਸਕੂਲ ਖੁੱਲ੍ਹ ਜਾਂਦਾ ਜੀ ਹਾਂਜੀ ਹਾਂਜੀ ਨੌ ਵਜੇ ਸਕੂਲ ਖੁੱਲ੍ਹ ਜਾਂਦਾ ਜੀ ਹੁਣ ਤੱਕ ਬੜੀਆ ਓਕੇ ਮੈਮ ਥੈਂਕ ਯੂ ਮੈਡਮ ਥੈਂਕ ਯੂ